ਪੰਜਾਬ ਦੇ ਸੱਭਿਆਚਾਰ ਵਿੱਚ ਪੰਜਾਬੀ ਭੰਗੜੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਪੰਜਾਬ ਪੰਜਾਬ ਦੀ ਸੱਭਿਆਚਾਰਕ ਜਿਵੇਂ ਕਿ ਮੇਲੇ ਜਾਂ ਲੋਹੜੀ ਦੇ ਤਿਉਹਾਰ ਜਾਂ ਹੋਰ ਵੀ ਤਿਉਹਾਰ ਹਰ ਇੱਕ ਤਿਉਹਾਰ ਜਿਵੇਂ ਕਿ ਕੋਈ ਵੀ ਖੁਸ਼ੀ ਦਾ ਸਮਾਗਮ ਹੁੰਦਾ ਹੈ ਅਤੇ ਪੰਜਾਬੀ ਲੋਕ ਭੰਗੜਾ ਪਾਉਂਦੇ ਹਨ ਅਤੇ ਇਹ ਭੰਗੜਾ ਪੰਜਾਬ ਵਿੱਚ ਜ਼ਿਆਦਾਤਰ ਮੇਲਿਆਂ ਵਿੱਚ ਅਤੇ ਸ਼ਾਦੀਆਂ ਵਿਆਹਾਂ ਦੇ ਵਿੱਚ ਪਾਇਆ ਜਾਂਦਾ ਹੈ ਇਸ ਨਾਲ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ ਅਤੇ ਭੰਗੜਾ ਪਾਉਣਾ ਜਿਸ ਨਾਲ ਸਰੀਰਕ ਗਤੀਵਿਧੀਆਂ ਵੀ ਵਧੀਆ ਹੁੰਦੀਆਂ ਹੈ ਅਤੇ ਸਰੀਰ ਵਿਚ ਰੌਣਕ ਬਣੀ ਰਹਿੰਦੀ ਹੈ ਅਤੇ ਇੱਕ ਖੁਸ਼ੀ ਦਾ ਪਲ ਹੈ ਜਿਹੜਾ ਭੰਗੜੇ ਦਾ ਨਾਲ ਇਜ਼ਹਾਰ ਕੀਤਾ ਜਾਂਦਾ ਹੈ ਇਸ ਲਈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸਹੀ ਹੈ ਹੁੰ ਕਰ ਦਿਓ